ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਸਰ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਸਰ ਅੱਛਾ ਅੱਛਾ ਅੱਛਾ ਹਾਂਜੀ ਦੱਸੋ ਅੱਛਾ ਅੱਛਾ ਅੱਛਾ ਜਗਮੋਹਨ ਸਾਰਿਆਂ ਤੋਂ ਪਹਿਲਾਂ ਆਪਣੀ ਏਜ ਦੱਸ ਦਿਓ ਕਿੰਨੀ ਆ ਏਜ ਕਿੰਨੀ ਹੈਗੀ ਤੁਹਾਡਾ ਵੇਟ ਕਿੰਨਾ ਗਾ ਅਤੇ ਹਾਈਟ ਕਿੰਨੀ ਆ ਤੁਹਾਡੀ ਹਾਂਜੀ ਅੱਛਾ ਹਾਈਟ ਪੰਜ ਫੁੱਟ ਗਿਆਰਾਂ ਇੰਚ ਠੀਕ ਹੈ ਜੀ ਅਤੇ ਵੇਟ ਵੇਟ ਅੱਸੀ ਕੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਅੱਗੇ ਬੋਲੋ ਜੀ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਜੀ ਅੱਛਾ ਅੱਛਾ ਠੀਕ ਹੈ ਅੱਛਾ ਅਤੇ ਇੱਕ ਤੁਹਾਡੀ ਵੇਟ ਦੀ ਸਮੱਸਿਆ ਹੈ ਨਾ ਅੱਛਾ ਅੱਛਾ ਅੱਛਾ ਠੀਕ ਹੈ ਵੇ ਵੇਟ ਵੀ ਤੁਹਾਡਾ ਜ਼ਿਆਦਾ ਆ ਹੈ ਨਾ ਅੱਛਾ ਹਾਂਜੀ ਜਗਮੋਹਨ ਜੀ ਮੈਂ ਇੱਕ ਐਲ ਐਫ ਟੀ ਟੈਸਟ ਕਰਵਾਏ ਤੁਸੀਂ ਲੀਬਰ ਫੰਕਸ਼ਨ ਟੈਸਟ ਕਦੇ ਅੱਛਾ ਇੱਕ ਤਾਂ ਨਾ ਆਪਾਂ ਉਹ ਕਰਵਾਵਾਂਗੇ ਠੀਕ ਹੈ ਜਦੋਂ ਤੁਸੀਂ ਮੇਰੇ ਕੋਲ ਅਗਲੀ ਵਾਰ ਆਊਗੇ ਤਾਂ ਐਲ ਐਫ ਟੀ ਕਰਵਾ ਕੇ ਲੈ ਕੇ ਆਇਓ ਨਾਲ ਠੀਕ ਹੈ ਜੀ ਅਤੇ ਦੂਜੀ ਗੱਲ ਮੈਂ ਤੁਹਾਨੂੰ ਇਹਦੇ ਵਾਸਤੇ ਜੋ ਤੁਹਾਡੀ ਕੋਸਟੀਪੇਸ਼ਨ ਹੈਗੀ ਹੈਗੀ ਇਹਦੇ ਬਾਰੇ ਇਸ ਵਾਸਤੇ ਦੱਸ ਦਾਂਗੇ ਠੀਕ ਹੈ ਉਹ ਨੋਟ ਕਰ ਲਓ ਠੀਕ ਹੈ ਤੁਹਾਨੂੰ ਥੋੜ੍ਹਾ ਜਿਹਾ ਡਾਇਟ ਪਲੈਨ ਦਿੰਦਾ ਤਾਂ ਉਹ ਫੋਲੋ ਕਰੋ ਪੰਦਰਾਂ ਕੁ ਦਿਨਾਂ ਬਾਅਦ ਤੁਸੀਂ ਮੈਨੂੰ ਦਿਖਾਓ ਠੀਕ ਹੈ ਨੋਟ ਕਰ ਲਓ ਇੱਕ ਤਾਂ ਸਵੇਰੇ ਥੋੜਾ ਜਿਹਾ ਜਲਦੀ ਉੱਠਣਾ ਗਾ ਠੀਕ ਐ ਉੱਦੋਂ ਬਾਅਦ ਸਵੇਰੇ ਉੱਠਣ ਸਾਰ ਥੋੜ੍ਹਾ ਜਿਹਾ ਕੋਸਾ ਪਾਣੀ ਠੀਕ ਹੈ ਵਿੱਚ ਥੋੜ੍ਹਾ ਜਿਹਾ ਸ਼ਹਿਦ ਵਿੱਚ ਨਿੰਬੂ ਪਾ ਕੇ ਉਹਨੂੰ ਪੀਣਾ ਠੀਕ ਹੈ ਸਿਪ ਸਿਪ ਕਰਕੇ ਬੈਠ ਕੇ ਪੀਣਾ ਓਕੇ ਫਿਰ ਉਸ ਤੋਂ ਬਾਅਦ ਗਰਾਊਂਡ ਜਾਣਾ ਗਾ ਰਨਿੰਗ ਕਰਨੀ ਹੈ ਹਲਕੀ ਜ਼ਿਆਦਾ ਠੀਕ ਹੈ ਅਤੇ ਐਕਸਰਸਾਈਜ਼ਾ ਕਰਨੀਆਂ ਨੇ ਕੁਛ ਕੁ ਠੀਕ ਹੈ ਸਟਰੈਚਿੰਗ ਕਰਨੀ ਬੋਡੀ ਦੀ ਅਤੇ ਉੱਦੋਂ ਬਾਅਦ ਵਾਪਿਸ ਆ ਕੇ ਅਤੇ ਨਾਸ਼ਤੇ ਦੇ ਵਿੱਚ ਹਲਕਾ ਫੁਲਕਾ ਲੈਣਾ ਗਾ ਜੋ ਵੀ ਤੁਸੀਂ ਖਾਂਦੇ ਪੀਂਦੇ ਹੋਊਗੇ ਅਤੇ ਇੱਕ ਵਾਰ ਤੁਸੀਂ ਜੋ ਤੁਹਾਡਾ ਦੁੱਧ ਹੈਗਾ ਗਾ ਸ਼ਾਮ ਨੂੰ ਰਾਤ ਨੂੰ ਪੀਂਦੇ ਹੋ ਹੈ ਨਾ ਤੁਸੀਂ ਉਹ ਬੰਦ ਕਰਨਾ ਠੀਕ ਹੈ ਕੁਛ ਟਾਈਮ ਵਾਸਤੇ ਬੰਦ ਕਰ ਦਿਓ ਠੀਕ ਹੈ ਅਤੇ ਆਪਣਾ ਨਾਸ਼ਤੇ ਤੋਂ ਬਾਅਦ ਤੁਸੀਂ ਦੁਪਹਿਰੇ ਲੰਚ ਦੇ ਵਿੱਚ ਜੇ ਮਤਲਬ ਤੁਸੀਂ ਤਿੰਨ ਰੋਟੀਆਂ ਖਾਂਦੇ ਹੋ ਤਾਂ ਦੋ ਕਰ ਜਾਂ ਇੱਕ ਕਰ ਲਓ ਡੇਢ ਕਰ ਦਿਓ ਅਤੇ ਉਹਦੀ ਜਗ੍ਹਾ ਤੁਸੀਂ ਆਪਣਾ ਕੋਈ ਵੀ ਜੂਸ ਵਗੈਰਾ ਪੀਓਗੇ ਸੀਜ਼ਨਲ ਠੀਕ ਆ ਫਰੂਟ ਖਾਣੇ ਹੈਗੇ ਵੱਧ ਤੋਂ ਵੱਧ ਜਿਹੜੇ ਆਸ ਵਾਲੇ ਹੁੰਦੇ ਸੈਟਰਿਕ ਠੀਕ ਹੈ ਇਹ ਜੂਸ ਪੀਣਾ ਵੱਧ ਤੋਂ ਵੱਧ ਠੀਕ ਹੈ ਅਤੇ ਜਿਹੜਾ ਰਾਤ ਦਾ ਨਾਸ਼ਤਾ ਹੈ ਰਾਤ ਦੀ ਰੋਟੀ ਹੈਗੀ ਉਹ ਜਲਦੀ ਕਰਨੀ ਹੈਗੀ ਠੀਕ ਹੈ ਅਤੇ ਦੁੱਧ ਨਹੀਂ ਪੀਣਾ ਹੈਗਾ ਅਤੇ ਸੈਲਡ ਵੱਧ ਤੋਂ ਵੱਧ ਖਾਣਾ ਠੀਕ ਹੈ ਹਾਂ ਠੀਕ ਹੈ ਅਤੇ ਉੱਦੋਂ ਬਾਅਦ ਮੈਨੂੰ ਦਿਖਾਇਓ ਠੀਕ ਹੈ ਪੰਦਰਾਂ ਦਿਨ ਓਕੇ ਜੀ